ਅਸੀਂ ਪੌਦੇ ਉਗਾਉਣ ਲਈ ਕਈ ਪ੍ਰਕਾਰ ਦੀ ਮਿੱਟੀ ਦੀ ਵਰਤੋਂ ਕਰਦੇ ਹਾਂ ਜਿਵੇਂ ਕਾਲੀ ਮਿੱਟੀ ਲਾਲ ਮਿੱਟੀ ਰੇਤਲੀ ਮਿੱਟੀ ਚੀਕਣੀ ਮਿੱਟੀ ਅਨੇਕ ਪ੍ਰਕਾਰ ਦੀ ਮਿੱਟੀ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਮਿੱਟੀ ਦੇ ਵਿੱਚ ਪੌਦੇ ਬਹੁਤ ਹੀ ਵਧੀਆ ਉੱਗਦੇ ਆ ਇਹ ਮਿੱਟੀ ਪੌਦੇ ਉਗਾਉਣ ਦੇ ਲਈ ਉਪਜਾਊ ਹੁੰਦੀ ਹੈ ਅਸੀਂ ਪੌਦਿਆਂ ਦੇ ਲਈ ਕਈ ਪ੍ਰਕਾਰ ਦੀ ਖਾਦ ਦੀ ਵਰਤੋਂ ਵੀ ਕਰਦੇ ਹਾਂ ਜਿਵੇਂ ਔਰਗੈਨਿਕ ਖਾਦ ਯੂਰੀਆ ਖਾਦ ਰੂੜੀ ਖਾਦ ਆਦਿ ਕਈ ਹੋਰ ਪ੍ਰਕਾਰ ਦੀਆਂ ਖਾਦਾਂ ਆਰਗੈਨਿਕ ਖਾਦ ਜਿਹੜੀ ਆ ਉਹ ਗਲੇ ਸੜੇ ਪੌਦਿਆਂ ਤੋਂ ਤਿਆਰ ਕੀਤੀ ਜ ਗਲੇ ਸੜੇ ਪੱਤਿਆਂ ਤੋਂ ਤਿਆਰ ਕੀਤੀ ਜਾਂਦੀ ਆ ਰਸੋਈ ਦਾ ਜੋ ਵੈਸਟ ਮਟੀਰੀਅਲ ਹੁੰਦਾ ਸਬਜ਼ੀਆਂ ਦੇ ਛਿਲਕੇ ਜਾਂ ਕੁਛ ਹੋਰ ਵੀ ਵਗੈਰਾ ਆਦਿ ਹੈ ਨਾ ਉਹਨਾਂ ਤੋਂ ਤਿਆਰ ਕੀਤੀ ਜਾਂਦੀ ਆ ਰੂੜੀ ਖਾਦ ਜਿਹੜੀ ਆ ਉਹ ਪਸ਼ੂਆਂ ਦੇ ਗੋਬਰ ਤੋਂ ਤਿਆਰ ਕੀਤੀ ਜਾਂਦੀ ਆ ਅਤੇ ਜਿਹੜੀ ਯੂਰੀਆ ਖਾਦ ਹੁੰਦੀ ਆ ਉਹ ਇੱਕ ਰਸਾਇਣਿਕ ਖਾਦ ਹੁੰਦੀ ਆ ਜਿਹੜੀ ਪੌਦਿਆਂ ਦੇ ਵਾਧੇ ਦੇ ਲਈ ਪੌਦਿਆਂ ਨੂੰ ਉਗਾਉਣ ਦੇ ਲਈ ਪਾਈ ਜਾਂਦੀ ਆ